ਸਾਡੇ ਅਨੁਸਾਰ ਤਾਂ ਭੰਗੜਾ ਬਾਲੀਵੁੱਡ ਡਾਂਸ ਨਾਲੋਂ ਵੱਖਰਾ ਹੈ ਬਾਲੀਵੁੱਡ ਡਾਂਸ ਜੋ ਕਿ ਹੁੰਦਾ ਕਿ ਉਹ ਕੀ ਹੱਥਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਲੱਤਾਂ ਦਾ ਕਰਦੇ ਆ ਇਹ ਭੰਗੜਾ ਜੋ ਵੀ ਹੈ ਇਹ ਜ਼ਿਆਦਾ ਤਾਂ ਪੱਟਾਂ ਦੇ ਜ਼ੋਰ 'ਤੇ ਪੈਂਦਾ ਅਤੇ ਜਦੋਂ ਆਪਾਂ ਇਹ ਭੰਗੜਾ ਪਾਉਂਦੇ ਆ ਤਾਂ ਇਹ ਇਹ ਸਾਨੂੰ ਇਹਦੇ ਨਾਲ ਅਲੱਗ ਲੱਗਦਾ ਵੀ ਇਹ ਜੋ ਵੀ ਹੈ ਪਹਿਲਾਂ ਤੋਂ ਹੀ ਹੁੰਦਾ ਵੀ ਇਸ ਤਰ੍ਹਾਂ ਹੀ ਪਾਉਣਾ ਭੰਗੜਾ ਅਤੇ ਜੋ ਦੂਜਾ ਡਾਂਸ ਹੈ ਉਹ ਜੋ ਜਿਵੇਂ ਗਾਣਾ ਚੱਲਦਾ ਹੈ ਉਸ ਹਿਸਾਬ ਨਾਲ ਉਹ ਉਹਨਾਂ ਨੂੰ ਡਾਂਸ ਕਰਨਾ ਪੈਂਦਾ ਅਤੇ ਇਹ ਜਿਹੜਾ ਸਾਨੂੰ ਇਹ ਵੀ ਉਹਨਾਂ ਨਾਲੋਂ ਇਹਨਾਂ ਦਾ ਰੂਪ ਵੱਖਰਾ ਹੈ ਅਤੇ ਬਾਕੀ ਵੀ ਭੰਗੜਾ ਸਰੀਰਿਕ ਦਿਮਾਗੀ ਕਸਰਤ ਤਾਂ ਹੈ ਹੀ ਇਹਦੇ ਨਾਲ ਅਤੇ ਬਿਮਾਰੀਆਂ ਤੋਂ ਤਾਂ ਬਚਾਉਂਦਾ ਹੀ ਬਚਾਉਂਦਾ ਹੈ ਅਤੇ ਸਾਨੂੰ ਭੰਗੜਾ ਕਰਨਾ ਚਾਹੀਦਾ ਅਤੇ ਬਾਕੀ ਇਹ ਇਹ ਸਾਡਾ ਮਤਲਬ ਵੱਖਰਾ ਸਭ ਤੋਂ ਵੱਖਰਾ ਭੰਗੜਾ ਹੈ ਸਾਨੂੰ ਇਹ ਕਰਨਾ ਚਾਹੀਦਾ ਅਤੇ ਹੋਰ ਇਹਦੇ 'ਤੇ ਭੰਗੜੇ ਦੇ ਵਿੱਚ ਜ਼ਿਆਦਾ ਜ਼ੋਰ ਲੱਗਦਾ ਭੰਗੜਾ ਬਹੁਤ ਹੀ ਜ਼ਿਆਦਾ ਸਰੀਰਿਕ ਦੀ ਵਰਜਿਸ਼ ਹੁੰਦੀ ਭੰਗੜੇ ਨਾਲ ਅਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਸਾਨੂੰ ਭੰਗੜਾ ਅਤੇ ਡਾਂਸ ਅਤੇ ਇਹ ਹੋਰ ਇਹਦਾ ਇਹਦਾ ਕਿਤਾਬ ਹਿਸਾਬ ਕਿਤਾਬ ਹੋਰ ਆ ਕੋਈ ਤਾਂ ਅਸੀਂ ਇਹ ਜ਼ਿਆਦਾ ਭੰਗੜੇ 'ਤੇ ਹੀ ਜ਼ੋਰ ਦਿੰਦੇ ਭੰਗੜਾ ਕਰੀਏ ਅਤੇ ਭੰਗੜਾ ਜ਼ਿਆਦਾ ਜ਼ੋਰ ਨਾਲ ਪੈਂਦਾ ਅਤੇ ਇਹ ਸਾਰਿਆਂ ਨਾਲੋਂ ਵੱਖਰਾ ਹੈ